ਮੈਂ ਸੁਨੀਲ ਕੁਮਾਰ ਮਿਰਜਾਪੁਰ ਜ਼ਿਲ੍ਹਾ ਗੁਰਦਾਸਪੁਰ ਤੋਂ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਰੋਬਾਰ ਕਾਰੋਬਾਰ ਕਈ ਤਰ੍ਹਾਂ ਦੇ ਹਨ ਜਿਵੇਂ ਪਸ਼ੂਆਂ ਨੂੰ ਪਾਲਣਾ ਪਾਲਣ ਗਾਵਾਂ ਨੂੰ ਪਾਲਣਾ ਮੱਝਾਂ ਨੂੰ ਪਾਲਣਾ ਭੇਡਾਂ ਬੱਕਰੀਆਂ ਨੂੰ ਪਾਲਣਾ ਠੀਕ ਹੈ ਜੀ ਗਾਵਾਂ ਦੀ ਗੱਲ ਕਰਾਂ ਤਾਂ ਗਊਂ ਇੱਕ ਤਾਂ ਸਾਡੀ ਭਾਰਤ ਮਾਤਾ ਹੈ ਠੀਕ ਹੈ ਜੀ ਤਾਂ ਇਸ ਤੋਂ ਸਾਨੂੰ ਦੁੱਧ ਮਿਲਦਾ ਹੈ ਦੁੱਧ ਮਿਲਦਾ ਹੈ ਇਸਦੇ ਦੁੱਧ ਤੋਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਿਸ ਤਰ੍ਹਾਂ ਦਹੀਂ ਪਨੀਰ ਖੋਇਆ ਪਨੀਰ ਦੀ ਦੁੱਧ ਦਹੀਂ ਖੋਇਆ ਅਤੇ ਗਾਂ ਦਾ ਦੁੱਧ ਬਹੁਤ ਹੀ ਕੈਲਸ਼ੀਅਮ ਭਰਿਆ ਹੁੰਦਾ ਹੈ ਵਧੀਆ ਅਤੇ ਕੈਲਸ਼ੀਅਮ ਭਰਿਆ ਹੁੰਦਾ ਹੈ ਇਸ ਤਰ੍ਹਾਂ ਮੱਝ ਦੇ ਦੁੱਧ ਦੀ ਗੱਲ ਕਰਾਂ ਤਾਂ ਮੱਝ ਦਾ ਦੁੱਧ ਇੱਕ ਤਾਂ ਭਾਰਾ ਹੁੰਦਾ ਹੈ ਦੂਜਾ ਮਹਿੰਗਾ ਵੀ ਹੁੰਦਾ ਹੈ ਅਤੇ ਜੇ ਪਾਲਣ ਪੋਸ਼ਣ ਦੀ ਗੱਲ ਕੀਤੀ ਜਾਵੇ ਤਾਂ ਗਾਂ ਦਾ ਦੁੱਧ ਜਿਹੜਾ ਉਹ ਵਧੀਆ ਹੁੰਦਾ ਹੈ ਕੁਝ ਲੋਕੀਂ ਮੱਝ ਪਸੰਦ ਕਰਦੇ ਹਨ ਅਤੇ ਕੁਝ ਗਾਂ ਦਾ ਦੁੱਧ ਪਸੰਦ ਕਰਦੇ ਹਨ ਗੱਦੀ ਭੇਡਾਂ ਦਾ ਦੁੱਧ ਭੇਡਾਂ ਪਾਲਦੇ ਹਨ ਅਤੇ ਉਸ ਤੋਂ ਸਾਨੂੰ ਉੱਨ ਮਿਲਦੀ ਹੈ ਅਤੇ ਉਨ੍ਹਾਂ ਦਾ ਭੇਡੂ ਬੱਕਰਾ ਮੀਟ ਵਗੈਰਾ ਵੀ ਉਨ੍ਹਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਆਰਮੀ ਨੂੰ ਵੀ ਡਿਫੈਂਸ ਡਿਪਾਟਮੈਂਟ ਨੂੰ ਵੀ ਸਪਲਾਈ ਹੁੰਦਾ ਹੈ ਧੰਨਵਾਦ